ਮੈਨੂੰ ਤਾਂ ਪੰਜਾਬੀ ਗਾਣੇ ਸੁਣਨਾ ਅਤੇ ਉਹਨਾਂ ਦੇ ਉੱਤੇ ਨੱਚਣਾ ਟੱਪਣਾ ਬੜਾ ਹੀ ਚੰਗਾ ਲੱਗਦਾ ਹੈ ਅਤੇ ਇਸ ਭੰਗੜੇ ਦੇ ਨਾਲ ਸਾਡੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ ਇਸ ਕਰਕੇ ਮੈਂ ਭੰਗੜਾ ਅਰੋਬਿਕਸ ਕਲਾਸ ਵੀ ਜੁਆਇਨ ਕੀਤੀ ਹੈ ਮੈਂ ਰੋਜ਼ ਸਵੇਰੇ ਉੱਠ ਕੇ ਛੇ ਵਜੇ ਉਸ ਕਲਾਸ ਵਿੱਚ ਜਾਂਦੀ ਹਾਂ ਅਤੇ ਉੱਥੇ ਜਾ ਕੇ ਸਾਡੇ ਮਾਸਟਰ ਜੀ ਵਧੀਆ ਵਧੀਆ ਭੰਗੜੇ ਦੇ ਗਾਣੇ ਲਾ ਕੇ ਅਤੇ ਉਹਦੇ 'ਤੇ ਸਾਨੂੰ ਨੱਚਣਾ ਸਿਖਾਉਂਦੇ ਹਨ ਅਤੇ ਇਹਦੇ ਨਾਲ ਹੀ ਸਾਨੂੰ ਅਰੋਬਿਕਸ ਵੀ ਕਰਵਾਈ ਜਾਂਦੀ ਹੈ ਇਸ ਨਾਚ ਗਾਣੇ ਦੇ ਨਾਲ ਸਾਡੇ ਸਰੀਰ ਦੀ ਵਾਹਵਾ ਵਰਜਿਸ਼ ਹੋ ਜਾਂਦੀ ਹੈ ਅਤੇ ਸਾਡਾ ਸਰੀਰ ਚੁਸਤ ਅਤੇ ਤੰਦਰੁਸਤ ਫੀਲ ਕਰਦਾ ਹੈ ਅਤੇ ਜਦੋਂ ਅਸੀਂ ਇਸ ਵਧੀਆ ਵਧੀਆ ਗਾਣੇ ਭੰਗੜੇ ਅਤੇ ਕਸਰਤ ਦੇ ਨਾਲ ਆਪਣਾ ਦਿਨ ਸ਼ੁਰੂ ਕਰਦੇ ਹਾਂ ਤਾਂ ਸਾਰਾ ਦਿਨ ਬੜਾ ਹੀ ਵਧੀਆ ਚੁਸਤੀ ਅਤੇ ਸਫੁਰਤੀ ਦਾ ਬੀਤਦਾ ਹੈ ਅਤੇ ਉਹ ਤੋਂ ਬਾਅਦ ਮੈਂ ਘਰ ਆ ਕੇ ਵੀ ਇਸ ਹੀ ਸੁਭਾਅ ਦੇ ਵਿੱਚ ਸਾਰਾ ਦਿਨ ਮੌਜ ਮਸਤੀ ਦੇ ਵਿੱਚ ਆਪਣੇ ਕੰਮ ਕਰਦੀ ਰਹਿੰਦੀ ਹਾਂ ਉੱਥੇ ਸਾਨੂੰ ਮਾਸਟਰ ਜੀ ਵੱਖ ਵੱਖ ਤਰ੍ਹਾਂ ਦੇ ਗਾਣੇ ਲਾ ਕੇ ਅਤੇ ਕਈ ਨਵੇਂ ਨਵੇਂ ਡਾਂਸ ਦੇ ਸਟੈਪ ਸਿਖਾ ਕੇ ਸਾਨੂੰ ਕਸਰਤ ਕਰਵਾਉਂਦੇ ਹਨ ਉਹ ਉੱਥੇ ਸਾਨੂੰ ਬੜਾ ਹੀ ਮਜ਼ੇਦਾਰ ਅਤੇ ਵਧੀਆ ਸੁਖਾਵਾਂ ਮਾਹੌਲ ਬਣਾ ਦਿੰਦੇ ਹਨ ਜਿਸ ਦੇ ਕਰਕੇ ਸਾਡਾ ਮਨ ਕਰਦਾ ਹੈ ਕਿ ਅਸੀਂ ਉੱਥੇ ਆਪਣਾ ਦਿਨ ਬਿਤਾ ਕੇ ਉੱਥੇ ਹੀ ਆਪਣੇ ਚੰਗੇ ਦਿਨ ਦੀ ਸ਼ੁਰੂਆਤ ਕਰੀਏ ਅਤੇ ਮੈਨੂੰ ਉੱਥੇ ਜਾ ਕੇ ਬੜਾ ਹੀ ਚੰਗਾ ਮਹਿਸੂਸ ਹੁੰਦਾ ਹੈ ਧੰਨਵਾਦ